ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਆ ਭੈਣ ਜੀ ਬਸ ਭੈਣ ਜੀ ਮੇਰਾ ਵੀ ਵਧੀਆ ਹਾਂਜੀ ਭੈਣ ਜੀ ਮੈਨੂੰ ਪਤਾ ਹੈ ਕਿਸਾਨ ਮੇ ਮਤਲਬ ਅਗਰ ਕਿਸਾਨ ਨਹੀਂ ਹੋਣਗੇ ਤਾਂ ਕਿਸਾਨ ਖੇਤਾਂ ਵਿੱਚ ਅਗਰ ਅਨਾਜ ਨਹੀਂ ਉਗਾਉਣਗੇ ਅਤੇ ਜਿਹੜੀ ਅਸੀਂ ਰੋਟੀ ਖਾ ਰਹੇ ਹਾਂ ਅਤੇ ਉਹ ਸਾਨੂੰ ਰੋਟੀ ਕਿੱਥੋਂ ਮਿਲੇਗੀ ਕਿਸਾਨ ਉਗਾ ਰਿਹਾ ਤਾਂ ਅਸੀਂ ਰੋਟੀ ਖਾ ਰਹੇ ਕਿਸਾਨ ਅਗਰ ਸਬਜ਼ੀਆਂ ਤਿਆਰ ਕਰ ਰਿਹਾ ਹੈ ਨਾ ਆਪਣੇ ਖੇਤਾਂ ਵਿੱਚ ਤਾਂ ਹੀ ਅਸੀਂ ਉਹ ਸਬਜ਼ੀਆਂ ਖਾ ਰਹੇ ਹਾਂ ਨਹੀਂ ਅਗਰ ਉਹ ਇਹ ਚੀਜ਼ ਛੱਡ ਦੇਣਗੇ ਸਾਰੇ ਲੋਕ ਉਹਨਾਂ ਚੀਜ਼ਾਂ ਨੂੰ ਧਿਆਨ ਨਹੀਂ ਦੇਣਗੇ ਤਾਂ ਫਿਰ ਅਸੀਂ ਇਹ ਚੀਜ਼ਾਂ ਸਾਨੂੰ ਕਿੱਥੋਂ ਮਿਲਣਗੀਆਂ ਹਾਂਜੀ ਸਾਨੂੰ ਕਿਸਾਨਾਂ ਨੂੰ ਹਾਂ ਸਰਕਾਰ ਨੂੰ ਚਾਹੀਦਾ ਹੈਗਾ ਹਾਂ ਸਾਨੂੰ ਚਾਹੀਦਾ ਹੈਗਾ ਕਿ ਸਰਕਾਰ ਨੂੰ ਵੱਧ ਤੋਂ ਵੱਧ ਕਿਸਾਨਾਂ ਦੀ ਬਿਹਤਰੀ ਵਾਸਤੇ ਕੋਈ ਨਾ ਕੋਈ ਕੰਮ ਕਰਨੇ ਚਾਹੀਦੇ ਹਨ ਹਾਂਜੀ ਹਾਂਜੀ ਅਨਾਜ ਖਰੀਦਣਾ ਚਾਹੀਦਾ ਹਾਂਜੀ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ